ਹੈਲੋ ਹਾਂਜੀ ਅੱਛਾ ਜੀ ਅੱਛਾ ਜੀ ਅੱਛਾ ਜੀ ਅੱਛਾ ਜੀ ਹਾਂ ਉੱਥੇ ਰਾਜਸਥਾਨ 'ਚ ਮਸੂਰ ਹੈਗੀ ਆ ਅਤੇ ਬਹੁਤ ਵਧੀਆ ਚੀਜ਼ਾਂ ਮਿਲਦੀਆਂ ਉੱਥੇ ਮਰਜ਼ੀ ਕੋਈ ਚੀਜ਼ ਖਾ ਲਓ ਹਾਂ ਵਧੀਆ ਮਿਲਦੀ ਹੈਗੀ ਆ ਜੇ ਮਤਲਬ ਜਾ ਦਾਲ ਚੂਰਮਾ ਉਹ ਹੋ ਗਿਆ ਉਹ ਵੀ ਵਧੀਆ ਹੈਗੇ ਵਧੀਆ ਬਣਦੇ ਰਾਜਸਥਾਨ 'ਚ ਅਤੇ ਹਾਂ ਅਤੇ ਘਿਓ ਹੈਗਾ ਉਸ ਰਾਜਸਥਾਨ ਦਾ ਘਿਓ ਵੀ ਵਧੀਆ ਹੀ ਮਿਲਦਾ ਉੱਥੇ ਰਾਜਸਥਾਨ 'ਚੋਂ ਬਹੁਤ ਵਧੀਆ ਹੀ ਹੁੰਦਾ ਹੈਗਾ ਹਾਂਜੀ ਬਹੁਤ ਵਧੀਆ ਹੁੰਦਾ ਹਾਂ ਲਿਆ ਹਾਂ ਲਿਆ ਸਕਦੇ ਹੋ ਬਹੁਤ ਵਧੀਆ ਮਿਲਦਾ ਹੈਗਾ ਪਿਓਰ ਚੀਜ਼ ਮਿਲਦੀ ਆ ਮਿਕਸ ਅਤੇ ਨਹੀਂ ਕੋਈ ਚੀਜ਼ ਪਿਓਰ ਮਿਲਦੀ ਹੈ ਅਤੇ ਇੱਕ ਹੈਗੇ ਹੈ ਉੱਥੇ ਕੀ ਨਾਮ ਪਿਆਜ਼ ਕਚੋਰੀ ਮਿਲਦੀ ਉਹ ਵੀ ਮਸੂਰ ਹੈਗੀ ਆ ਪਿਆਜ਼ ਕਚੋਰੀ ਹਾਂ ਪਿਆਜ਼ ਕਚੋਰੀ ਮਸੂਰ ਹੈਗੀਆਂ ਉਹ ਵੀ ਬਹੁਤ ਮਸੂਰ ਆ ਖਾਣ 'ਚ ਵੀ ਬਹੁਤ ਟੇਸਟੀ ਹੁੰਦੀ ਆ ਹਾਂ ਹਾਂ ਕਰ ਸਕਦੇ ਉਹ ਜੀ ਅਤੇ ਔਰ ਹੈਗੇ ਆਪਣੇ ਉਹ ਬਣਾਉਂਦੇ ਆ ਕਿਹੜੇ ਬਾਜਰੇ ਦੀ ਰੋਟੀ ਆਉਂਦੀ ਆ ਉਹ ਵੀ ਪਿਓਰ ਬਣਦੀ ਹੈਗੀ ਆ ਵਧੀਆ ਹੁੰਦਾ ਆਪਣੇ ਇੱਥੋਂ ਨਾ ਵਧੀਆ ਹਾਂ ਹਾਂਜੀ ਵਧੀਆ ਹੁੰਦਾ ਹਾਂ ਨਹੀਂ ਜੀ ਕੋਈ ਮਿਲਾਵਟ ਨਹੀਂ ਹੁੰਦੀ ਜੀ ਨਹੀਂ ਕੋਈ ਮਿਲਾਵਟ ਹੈ ਨਹੀਂ ਜੀ ਵਧੀਆ ਮਿਲਦੀ ਹੈ ਵਧੀਆ ਬਣਦੀ ਆ ਬਹੁਤ ਟੇਸਟੀ ਲੱਗਦੀ ਆ ਅਤੇ ਇੱਕ ਉਹ ਹੁੰਦੀ ਹੈਗੀ ਆ ਕੀ ਨਾਮ ਪਿਆਜ਼ ਵਾਲੀ ਕਚੋਰੀ ਵੀ ਦੱਸ ਤਾ ਸੀ ਤੁਹਾਨੂੰ ਹੈ ਨਾ ਦੱਸ ਤਾ ਸੀਗਾ ਜੀ ਅਤੇ ਇੱਕ ਹੋਰ ਵੀ ਹੁੰਦੀ ਆਪਣੇ ਕੀ ਬੋਲਦੇ ਆ ਆਲੂ ਹਾਂ ਉਹ ਹਾਂ ਹੋ ਹੁੰਦੀ ਆ ਜੀ ਬਿਕਾਨੇਰੀ ਭੁੱਜੀਆਂ ਹੁੰਦੀ ਹੈ ਜੀ ਉੱਥੇ ਬਹੁਤ ਮਸੂਰ ਆ ਉਹ ਵੀ ਹਾਂ ਹਾਂ ਹਲਦੀ ਰਾਮ ਦੀ ਦਾਲਾਂ ਹੁੰਦੀਆਂ ਮਸੂ ਉਹ ਹੁੰਦੀਆਂ ਹੈਗੀਆਂ ਹਾਂਜੀ ਭੁੱਜੀਆਂ ਬਹੁਤ ਵਧੀਆ ਹੁੰਦੀ ਹੈ ਉਹ ਵੀ ਹਾਂਜੀ ਅਤੇ ਇੱਕ ਹੁੰਦਾ ਉਹ ਕਲਾਕੰਦ ਹੁੰਦਾ ਹੈ ਨਾ ਮਿਲਕ ਕੇਕ ਬੋਲਦੇ ਆ ਉਹ ਵੀ ਬਹੁਤ ਵਧੀਆ ਉਹ ਵੀ ਮਸੂਰ ਆ ਹਾਂਜੀ ਉਹ ਵੀ ਬਹੁਤ ਮਸੂਰ ਹੈ ਜੀ ਮਰਜ਼ੀ ਬਨ ਖਾਏ ਨੂੰ ਬਹੁਤ ਟੇਸਟੀ ਹੁੰਦਾ ਹੈਗਾ ਜੀ ਤੁਸੀਂ ਟਰਾਏ ਕਰਕੇ ਵੇਖ ਲਿਓ ਖਾ ਕੇ ਹਾਂਜੀ ਬਹੁਤ ਟੇਸਟੀ ਹੁੰਦੀ ਹੈ ਅਤੇ ਹੋਰ ਹੁੰਦੀ ਹੈ ਰਾਜਸਥਾਨ 'ਚ ਹੁੰਦੀ ਆ ਘੇ ਵਾਰੀ ਵੀ ਬਹੁਤ ਮਸੂਰ ਆ ਹਾਂ ਉੱਦਾਂ ਖੋਏ ਵਾਲੀ ਵੀ ਘੇਵਾਰੀ ਮਿਲਦੀ ਆ ਦੂਸੀ ਦੂਜੀ ਵੀ ਮਿਲਦੀ ਆ ਸਫ ਵਾਲੀ ਵੀ ਮਿਲਦੀ ਆ ਖੋਏ ਵਾਲੀ ਵੀ ਮਿਲਦੀ ਆ ਬਹੁਤ ਮਸੂਰ ਆ ਪਿਓਰ ਮਿਲਦੀ ਆ ਠੀਕ ਹੈ ਜੀ ਚਟਨੀ ਹਾਂਜੀ ਹਾਂਜੀ ਬਹੁਤ ਵਧੀਆ ਪੁੱਛ ਲਿਆ ਤੁਸੀਂ ਬਹੁਤ ਵਧੀਆ ਉਹ ਤਾਂ ਚਟਣੀ ਵੀ ਹਾਂਜੀ ਚਟਣੀ ਵੀ ਬਣਾਉਂਦੇ ਹਾਂ ਚਟਣੀ ਵੀ ਬਹੁਤ ਸਵਾਦ ਬਣਦੀ ਆ ਟੇਸਟੀ ਬਣਦੀ ਆ ਰਾਜਸਥਾਨੀ ਹਾਂ ਬਹੁਤ ਟੇਸਟੀ ਬਣਦੀ ਆ ਚਟਣੀ ਉੱਥੇ ਬਾਈ ਉਹ ਟਮਾਟਰ ਦੀ ਬਣਾ ਲਏ ਆਪਣਾ ਪਿਆਜ਼ ਦੀ ਬਣਾ ਲਓ ਕੁਛ ਦੀ ਚੀਜ਼ ਦੀ ਬਣਾ ਬਹੁਤ ਟੇਸਟੀ ਬਣਦੀ ਆ ਚਟਨੀ ਰਾਜਸਥਾਨੀ ਚਟਨੀ ਹਾਂ ਠੀਕ ਹੈ ਜੀ ਠੀਕ ਹੈ ਜੀ